ਤੁਹਾਡੇ ਅਨੁਸਾਰ ਉਹ ਮੁੱਖ ਕਾਰਕ ਕੀ ਹਨ ਜੋ ਭੰਗੜਾ ਐਰੋਬਿਕਸ ਨੂੰ ਸਰੀਰਕ ਤੌਰ 'ਤੇ ਚੁਣੌਤੀ ਪੂਰਨ ਅਤੇ ਮਜ਼ੇਦਾਰ ਬਣਾਉਂਦਾ ਹੈ ਭੰਗੜਾ ਐਰੋਬਿਕਸ ਨੂੰ ਸਰੀਰਕ ਤੌਰ 'ਤੇ ਚੁਣੌਤੀਪੂਰਨ ਤਾਂ ਹੈ ਹੀ ਅਤੇ ਆਪਾਂ ਵਧੀਆ ਸੌਂਗ ਲਗਾ ਕੇ ਭੰਗੜਾ ਮਤਲਬ ਕਰ ਸਕ ਭੰਗੜਾ ਪਾ ਸਕਦੇ ਹਾਂ ਇਹਦੇ ਨਾਲ ਮਤਲਬ ਸਰੀਰਿਕ ਤੌਰ 'ਤੇ ਆਪਾਂ ਨੂੰ ਆਰਾਮ ਵੀ ਮਿਲਦਾ ਅਤੇ ਮਾਨਸਿਕ ਤੌਰ 'ਤੇ ਆਪਾਂ ਆਪਣੇ ਆਪ ਨੂੰ ਫਿਟ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਵਧੀਆ ਵੀ ਲੱਗਦਾ ਭੰਗੜੇ ਦੇ ਨਾਲ ਨਾਲ ਮਤਲਬ ਐਕਸਰਸਾਈਜ਼ ਵੀ ਹੋ ਜਾਂਦੀ ਹੈ ਤੇ ਇੰਜੋਏਮੈਟ ਵੀ ਆਪਣਾ ਬਹੁਤ ਵਧੀਆ ਹੋ ਜਾਂਦਾ ਚੁਣੌਤੀਪੂਰਨ ਤਾਂ ਹੈ ਹੀ ਆ ਅਤੇ ਇਹਦੇ ਨਾਲ ਮਤਲਬ ਸਰੀਰ ਆਪਣਾ ਬਹੁਤ ਵਧੀਆ ਫਿਟ ਰਹਿੰਦਾ ਹੈ ਅਤੇ ਬਾਕੀ